ਮੋਹਾਲੀ ਜ਼ਿਲ੍ਹੇ ਵਿੱਚ ਆਵਾਜਾਈ ਦੇ ਬਹੁਤ ਸਾਰੇ ਸਾਧਨ ਹਨ ਜਿਵੇਂ ਕਿ ਕਾਰ ਮੋਟਰਸਾਈਕਲ ਬੱਸ ਆਟੋ ਹਵਾਈ ਜਹਾਜ਼ ਇਹ ਸਾਰੇ ਜ਼ਿਲ੍ਹੇ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ